ਜਾਨਵਰਾਂ ਦੇ ਨਾਲ ਮੇਰਾ ਰਿਸ਼ਤਾ ਬਹੁਤ ਹੀ ਵਧੀਆ ਹੈ ਅਤੇ ਮੈਨੂੰ ਜਾਨਵਰ ਬਹੁਤ ਹੀ ਪਸੰਦ ਹਨ ਅਸੀਂ ਘਰ ਮੁਰਗੇ ਪਾਲੇ ਹੋਏ ਨੇ ਅਸੀਂ ਛੋਟੇ ਛੋਟੇ ਮੁਰਗਿਆਂ ਦੇ ਪਹਿਲੇ ਬੱਚਿਆਂ ਨੂੰ ਖਰੀਦਿਆ ਫਿਰ ਉਹਨਾਂ ਨੂੰ ਪਾਲਿਆ ਪਾਲ ਪੂਲ ਕੇ ਫਿਰ ਅਸੀਂ ਉਹਨਾਂ ਦੀ ਦੇਖ ਰੇਖ ਕੀਤੀ ਅਤੇ ਅਸੀਂ ਉਹਨਾਂ ਨੂੰ ਟਾਈਮ ਸਿਰ ਦਾਣਾ ਟਾਈਮ ਸਿਰ ਪਾਣੀ ਹਰ ਇੱਕ ਚੀਜ਼ ਟਾਈਮ ਸਿਰ ਦਿੰਦੇ ਹਾਂ ਅਸੀਂ ਉਹਨਾਂ ਨੂੰ ਆਪਣੇ ਘਰ ਦੇ ਜੀਆਂ ਵਾਂਗ ਹੀ ਪਾਲਦੇ ਹਨ ਅਸੀਂ ਉਹਨਾਂ ਲਈ ਇੱਕ ਵੱਖਰਾ ਛੋਟਾ ਜਿਹਾ ਉਹਨਾਂ ਦਾ ਅਲੱਗ ਘਰ ਬਣਾ ਕੇ ਦਿੱਤਾ ਹੋਇਆ ਵਾ ਜਿਹਦੇ ਵਿੱਚ ਉਹ ਆਪਾਂ ਨੂੰ ਉਹ ਨੂੰ ਆਪਣਾ ਘਰ ਸਮਝ ਕੇ ਹੀ ਰਹਿੰਦੇ ਨੇ ਅਸੀਂ ਮੁਰਗਿਆਂ ਦੇ ਬਿਮਾਰ ਪੈਣ ਦੇ ਨਾਲ ਉਹਨਾਂ ਨੂੰ ਟਾਈਮ ਸਿਰ ਦਵਾਈ ਵੀ ਲੈ ਕੇ ਦਿੰਦੇ ਹਨ ਅਤੇ ਅਸੀਂ ਮੁਰਗਿਆਂ ਨੂੰ ਵਧੀਆ ਖਾਧ ਪਾਉਂਦੇ ਹਨ ਜਿਹਨਾਂ ਦੀ ਉਹਦੀ ਹੈਲਥ ਵਧੀਆ ਰਹਿੰਦੀ ਹੈ ਅਤੇ ਮੇਰਾ ਤਾਂ ਸ਼ੁਰੂ ਤੋਂ ਹੀ ਜਾਨਵਰਾਂ ਦੇ ਨਾਲ ਬਹੁਤ ਹੀ ਵਧੀਆ ਰਿਹਾ ਹੈ ਅਤੇ ਮੈਨੂੰ ਸਾਰੇ ਹੀ ਜਾਨਵਰ ਬਹੁਤ ਪਸੰਦ ਹੈ ਮੈਨੂੰ ਕੁੱਤੇ ਵੀ ਬਹੁਤ ਪਸੰਦ ਹਨ ਮੈਨੂੰ ਹਰ ਇੱਕ ਤਰ੍ਹਾਂ ਦੇ ਜਾਨਵਰ ਬਹੁਤ ਪਸੰਦ ਹੈ ਪਰ ਪਾਲਣ ਦੇ ਸ਼ੌਂਕ ਦੇ ਵਿੱਚ ਮੈਨੂੰ ਮੁਰਗੇ ਪਸੰਦ ਹਨ ਕਿਉਂਕਿ ਮੁਰਗੇ ਤੋਂ ਇੱਕ ਤਾਂ ਉਹ ਥੋੜ੍ਹਾ ਕਮਾਉਣ ਦਾ ਸਾਧਨ ਬਣਦੇ ਨੇ ਦੂਜਾ ਖਿਲਾਰਾ ਘੱਟ ਪਾਉਂਦੇ ਨੇ ਦੂਸਰਾ ਉਹਨਾਂ ਦੇ ਆਂਡੇ ਵੀ ਬੱਚਿਆਂ ਦੇ ਖਾਣ ਦੇ ਕੰਮ ਆਉਂਦੇ ਨੇ